ਪਰਮਾਤਮਾ ਵੱਲੋਂ ਬਖਸ਼ਿਆ ਹੋਇਆ ਕੋਈ ਵੀ ਗੁਣ ਹਮੇਸ਼ਾ ਲਾਭਕਾਰੀ ਹੀ ਹੁੰਦਾ ਹੈ ਭਾਵੇਂ ਉਹ ਚਿੱਤਰਕਾਰੀ ਹੋਵੇ ਜਾਂ ਕਲਾਕਾਰੀ ਯਾਂ ਗਾਉਣ ਦੀ ਕਲਾ ਹੋਵੇ ਇਕ ਵਿਅਕਤੀ ਵਿੱਚ ਜਦੋਂ ਪਰਮਾਤਮਾ ਦੁਆਰਾ ਬਖਸ਼ਿਆ ਹੋਇਆ ਕੋਈ ਵੀ ਗੁਣ ਹੁੰਦਾ ਹੈ ਤਾਂ ਉਸਨੂੰ ਕਲਾਕਾਰ ਆਖਦੇ ਹਨ ਕਲਾਕਾਰ ਦੇ ਵਿੱਚ ਸਭ ਤੋਂ ਵੱਡਾ ਗੁਣ ਸਹਿਜਤਾ ਹੁੰਦੀ ਹੈ ਉਸ ਦੀ ਸਹਿਜਤਾ ਹੀ ਰੰਗਾਂ ਦੇ ਵਿੱਚ ਬਰੁਸ਼ ਡਬਾ ਕੇ ਆਪਣੀ ਭਾਵਨਾਵਾਂ ਨੂੰ ਚਿੱਤਰਕਾਰੀ ਦਾ ਰੂਪ ਦਿੰਦੀਆਂ ਹਨ ਦੂਸਰਾ ਕਿਸੇ ਵੀ ਕਲਾਕਾਰ ਦੀ ਕਲਪਨਾ ਸ਼ਕਤੀ ਮਜਬੂਤ ਹੁੰਦੀ ਹੈ ਜੋ ਉਹ ਕਲਪਨਾ ਵਿੱਚ ਵਿਚਰਦਾ ਹੈ ਉਹ ਰੰਗਾਂ ਨਾਲ ਕੈਨਵਸ ਤੇ ਉਤਾਰਦਾ ਹੈ ਉਸ ਦੀ ਬਤਾ ਬਣਾਈ ਹੋਈ ਰਚਨਾ ਦੂਜਿਆਂ ਲਈ ਇੱਕ ਮਿਸਾਲ ਹੁੰਦੀ ਹੈ ਇੱਕ ਕਲਾਕਾਰ ਸਾਫ ਦਿਲ ਵਾਲਾ ਨਿਰਛਲ ਵਿਅਕਤੀ ਹੁੰਦਾ ਹੈ ਜੋ ਆਪਣਾ ਹੀ ਨਹੀਂ ਬਲਕਿ ਸਾਰੇ ਸਮਾਜ ਬਾਰੇ ਸੋਚਦਾ ਹੈ ਇਸ ਲਈ ਚਿੱਤਰਕਾਰੀ ਪਰਮਾਤਮਾ ਵੱਲੋਂ ਬਖਸ਼ਿਆ ਹੋਇਆ ਇੱਕ ਉਭਾਰ ਉਪਕਾਰ ਹੈ